ਮੈਂ ਰੰਜਨ ਕੁਮਾਰ ਪਿੰਡ ਟੌਸਾਂ ਤੋਂ ਬੋਲਦਾ ਜੀ ਕੱਲ੍ਹ ਮੈਂ ਨਾ ਖਾਲਸਾ ਸਟੈਂਡ ਤੋਂ ਨੀ ਟੈਕਸੀ ਬੁੱਕ ਕਰਾਏ ਸੀਗਾ ਜੀ ਹਾਂਜੀ ਮੈਂ ਟੌਸਾਂ ਤੋਂ ਜਲੰਧਰ ਜਾਣਾ ਸੀਗਾ ਹਾਂਜੀ ਅਤੇ ਮੈਂ ਨਾ ਕਾਫੀ ਚਿਰ ਤੋਂ ਫੋਨ ਕਰ ਰਿਹਾ ਜੀ ਟੈਕਸੀ ਵਾਲੇ ਨੂੰ ਟੈਕਸੀ ਵਾਲਾ ਜੀ ਮੇਰਾ ਕੋਈ ਫੋਨ ਨਹੀਂ ਚੱਕ ਰਿਹਾ ਜੀ ਦਸ ਪੰਦਰਾਂ ਫੋਨ ਕਰਕੇ ਦੇਖ ਲਏ ਜੀ ਮੈਂ ਉਹਨੂੰ ਅਤੇ ਮੈ ਉਹਨੂੰ ਵਟਸਐਪ 'ਤੇ ਮੈਸੇਜ ਵੀ ਕੀਤਾ ਕਿ ਵੀ ਆਜਾ ਵੀ ਮੈਂ ਛੇਤੀ ਜਾਣਾ ਮੈਂ ਲੇਟ ਹੁੰਦਾ ਪਿਆ ਮੈਂ ਇੰਟਰਵਿਉ ਵਾਸਤੇ ਜਾਣਾ ਮੇਰੀ ਜੀ ਜਲੰਧਰ ਇੰਟਰਵਿਊ ਆ ਜੀ ਦਸ ਵਜੇ ਅੱਠ ਵਜੇ ਮੈਂ ਨਿਕਲਣਾ ਸੀਗਾ ਜੀ ਘਰੋਂ ਹਜੇ ਤੱਕ ਟੈਕਸੀ ਵਾਲਾ ਆਇਆ ਨਹੀਂ ਜੀ ਹੈਗਾ ਤੁਸੀਂ ਐਂ ਕਰੋ ਤੁਸੀਂ ਉਹਨੂੰ ਇੱਕ ਵਾਰੀ ਫੋਨ ਕਰਕੇ ਕਹਿ ਦਿਓ ਕਿ ਵੀ ਛੇਤੀ ਆ ਜਾ ਨਹੀਂ ਮੈਂ ਲੇਟ ਹੋ ਗਿਆ ਜੇ ਮੈਂ ਲੇਟ ਹੋ ਗਿਆ ਮੈਂ ਤੁਹਾਤੋਂ ਜੁਰਮਾਨਾ ਜੁਰਮਾਨਾ ਵੀ ਤੁਹਾਤੋਂ ਲਊਂਗਾ ਅਤੇ ਮੈਂ ਤੁਹਾਡੇ ਖਿਲਾਫ ਕੇਸ ਵੀ ਕਰੂੰਗਾ ਜੇ ਮੇਰੇ ਇੰਟਰਵਿਊ ਰਹਿ ਗਈ ਹਾਂਜੀ ਅਤੇ ਇੱਕ ਵਾਰੀ ਉਹਨੂੰ ਫੋਨ ਕਰ ਲਿਓ ਅਤੇ ਭੇਜੋ ਅਤੇ ਮੈਂ ਕਾਫੀ ਚਿਰ ਤੋਂ ਉਹਦੀ ਵੇਟ ਕਰ ਰਿਹਾ ਟੈਕਸੀ ਵਾਲੇ ਦੀ ਹਾਂਜੀ